ਮੈਨੂੰ ਫੋਟੋਗ੍ਰਾਫੀ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਮੈਂ ਜਿੱਥੇ ਵੀ ਜਾਂਦਾ ਹਾਂ ਆਪਣੇ ਫੋਨ ਦੇ ਕੈਮਰੇ ਵਿੱਚ ਜਾ ਮੇਰੇ ਕੋਲ ਜੋ ਕੈਮਰਾ ਹੈ ਉਸਨੂੰ ਨਾਲ ਲੈ ਕੇ ਜਾਂਦਾ ਤਾਂ ਕਿ ਮੈਂ ਉੱਥੋਂ ਦੇ ਵਿਊ ਨੂੰ ਕੈਪਚਰ ਕਰ ਸਕਾਂ ਅਤੇ ਇੱਕ ਯਾਦਗਾਰੀ ਜੋ ਆਪਣੇ ਕੋਲ ਸਾਂਭ ਕੇ ਰੱਖ ਸਕਾਂ ਮੈਂ ਜ਼ਿਆਦਾਤਰ ਪਹਾੜਾਂ ਦੀ ਸੈਰ ਕਰਨਾ ਪਸੰਦ ਕਰਦਾ ਉੱਥੇ ਮੈਂ ਕੁਦਰਤ ਦੇ ਜੋ ਨਜ਼ਾਰੇ ਨੇ ਉਹਨਾਂ ਨੂੰ ਇੱਕ ਕੈਮਰੇ ਵਿੱਚ ਕੈਦ ਕਰਕੇ ਉਸ 'ਤੇ ਬਹੁਤ ਹੀ ਸੋਹਣੀ ਸੁੰਦਰ ਤਸਵੀਰ ਖਿੱਚਦਾ ਅਤੇ ਜੋ ਮੈਂ ਤਸਵੀਰਾਂ ਅੱਜ ਤੱਕ ਖਿੱਚੀਆਂ ਹਨ ਉਹ ਨੇਚਰ ਦੇ ਬਹੁਤ ਹੀ ਜ਼ਿਆਦਾ ਨੇੜੇ ਅਤੇ ਇਤਿਹਾਸਿਕ ਜਗ੍ਹਾ 'ਤੇ ਜਾ ਕੇ ਉਹਨਾਂ ਦੀਆਂ ਤਸਵੀਰਾਂ ਲੈਣਾ ਵੀ ਮੇਰਾ ਇੱਕ ਸ਼ੌਂਕ ਹੈ ਜਿਨ੍ਹਾਂ ਨੂੰ ਮੈਂ ਲੋਕਾਂ ਨਾਲ ਵੀ ਸਾਂਝਾ ਕਰਦਾ ਹਾਂ ਲੋਕਾਂ ਤੱਕ ਵੀ ਪਹੁੰਚਾਉਂਦਾ ਹਾਂ ਅਤੇ ਆਪਣੇ ਮਨ ਦੇ ਸਕੂਨ ਲਈ ਵੀ ਉਹਨਾਂ ਤਸਵੀਰਾਂ ਨੂੰ ਸੰਭਾਲ ਕੇ ਰੱਖਦਾ ਹਾਂ ਜਦ ਵੀ ਮੈਨੂੰ ਉਹ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਉਹ ਲਿੱਤੇ ਹੋਏ ਨਜ਼ਾਰੇ ਮੇਰੇ ਅੱਖਾਂ ਸਾਹਮਣੇ ਫਿਰ ਤੋਂ ਘੁੰਮਣ ਲੱਗ ਜਾਂਦੇ ਹਨ